ਮੇਰੇ ਘਰ ਦੇ ਕੁਝ ਕੁ ਦੂਰੀ 'ਤੇ ਇੱਕ ਸਰਕਾਰੀ ਲਾਇਬ੍ਰੇਰੀ ਹੈ ਮੇਰੇ ਘਰ ਵਿੱਚ ਮੈਂ ਆਪਣੇ ਕਮਰੇ ਦੀ ਸਾਈਡ 'ਤੇ ਇੱਕ ਛੋਟੀ ਅਲਮਾਰੀ ਨੂੰ ਲ ਲਾਇਬ੍ਰੇਰੀ ਬਣਾਇਆ ਹੋਇਆ ਹੈ ਮੈਂ ਆਪਣੀ ਇੱਕ ਵੱਡੀ ਲਾਇਬ੍ਰੇਰੀ ਬਣਾਉਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਮੈਂ ਆਪਣੀ ਲਾਇਬ੍ਰੇਰੀ ਵਿੱਚ ਹਰ ਤਰ੍ਹਾਂ ਦੀ ਦੀਆਂ ਕਿਤਾਬਾਂ ਰੱਖਾਂਗੀ ਜਿਸ ਵਿੱਚ ਧਾਰਮਿਕ ਰਾਜਨੀਤਿਕ ਅਤੇ ਅਗਾਂਹਵਾਧੂ ਸੋਚ ਹੋ ਦੇਣ ਵਾਲੀਆਂ ਕਿਤਾਬਾਂ ਸ਼ਾਮਿਲ ਹੋਣਗੀਆਂ ਤਾਂ ਜੋ ਮੇਰੇ ਨਾਲ ਨਾਲ ਹੋਰ ਵੀ ਇਹਨਾਂ ਕਿਤਾਬਾਂ ਨੂੰ ਪੜ੍ਹ ਸਕੇ